ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੀਆ ਹੈ ਅਤੇ ਮੈਂ ਅੱਜ ਤੁਹਾਡੇ ਨਾਲ ਆਪਣਾ ਇੱਕ ਅਨੁਭਵ ਸ਼ੇਅਰ ਕਰਨਾ ਚਾਹੁੰਦੀ ਹਾਂ ਔਨਲਾਈਨ ਸ਼ੋਪਿੰਗ ਤੇ ਉੱਤੇ ਮੈਂ ਅੱਜ ਤੱਕ ਕਦੇ ਵੀ ਔਨਲਾਈਨ ਚੀਜ਼ਾਂ ਨਹੀਂ ਸੀ ਔਡਰ ਕੀਤੀਆਂ ਕਿਉਂਕਿ ਮੇਰਾ ਮੰਨਣਾ ਸੀ ਕਿ ਔਨਲਾਈਨ ਚੀਜ਼ਾਂ ਚੰਗੀਆਂ ਵੀ ਹੋ ਸਕਦੀਆਂ ਹਨ ਅਤੇ ਮਾੜੀਆ ਵੀ ਹੋ ਸਕਦੀਆਂ ਹਨ ਅਸੀਂ ਕਿੱਦਾਂ ਪਰਖਾਂਗੇ ਕਿ ਉਹ ਚੀਜ਼ ਜਿਹੜੀ ਹੈ ਉਹ ਚੰਗੀ ਹੈ ਜਾਂ ਮਾੜੀ ਹੈ ਕਿਉਂਕਿ ਮੈਂ ਆਪਣੇ ਹੱਥੀ ਚੀਜ਼ਾਂ ਦੇਖ ਪਰਖ ਕੇ ਹੀ ਖਰੀਦਣਾ ਪਸੰਦ ਕਰਦੀ ਹਾਂ ਪਰ ਮੈਨੂੰ ਹੈੱਡਫੋਨ ਦੀ ਜ਼ਰੂਰਤ ਪੈ ਗਈ ਸੀ ਅਤੇ ਇੰਨਾ ਸਮਾਂ ਨਹੀਂ ਸੀ ਕਿ ਮੈਂ ਆਪ ਜਾ ਕੇ ਅਤੇ ਬਾਜ਼ਾਰੋਂ ਦੇਖ ਪਰਖ ਕੇ ਹੈੱਡਫੋਨ ਲਿਆ ਸਕਾਂ ਤਾਂ ਮੈਨੂੰ ਮਜ਼ਬੂਰਨ ਔਨਲਾਈਨ ਔਡਰ ਕਰਨਾ ਪਿਆ ਅਤੇ ਜਦੋਂ ਅੱਜ ਉਹ ਆਏ ਅਤੇ ਮੈਂ ਦੇਖਿਆ ਜਦੋਂ ਖੋਲ੍ਹ ਕੇ ਅਤੇ ਉਸ ਪ੍ਰੋਡਕਟ ਨੂੰ ਜਦੋਂ ਮੈਂ ਚਲਾ ਕੇ ਦੇਖਿਆ ਤਾਂ ਉਸ ਦੀ ਵੋਇਸ ਰਿਕ ਡਿਲੀਵਰੀ ਜੋ ਸੀ ਬਹੁਤ ਹੀ ਵਧੀਆ ਸੀ ਅਤੇ ਕੁਆਲਿਟੀ ਦਾ ਤਾਂ ਮੈਂ ਜਵਾਬ ਨਹੀਂ ਦੇ ਸਕਦੀ ਜਿਹੜੇ ਮੈਂ ਲੋਕਲ ਖਰੀਦਦੀ ਸਾਂ ਉਹ ਵੀ ਬਹੁਤ ਹੀ ਉਹਨਾਂ ਤੋਂ ਵੀ ਇਹ ਬਹੁਤ ਹੀ ਵਧੀਆ ਨਿਕਲਿਆ ਮੈਂ ਬੋਟ ਦੇ ਬੋਟ ਦੇ ਹੈੱਡਫੋਨ ਜੋ ਸੀ ਉਹ ਔਡਰ ਕੀਤੇ ਸਨ ਅਤੇ ਜਦੋਂ ਉਹਨਾਂ ਦੀ ਡਿਲੀਵਰੀ ਹੋਈ ਤਾਂ ਇਹ ਓਰੀਜਨਲ ਹੀ ਸਨ ਕਿਉਂਕਿ ਇਹਨਾਂ ਦੀ ਕੁਆਲਿਟੀ ਵੋਇਸ ਕੁਆਲਿਟੀ ਜੋ ਸੀ ਬਹੁਤ ਹੀ ਵਧੀਆ ਸੀ ਅਤੇ ਇਹ ਕੰਨਾਂ ਨੂੰ ਪਾਉਣ ਵਿੱਚ ਬਹੁਤ ਹੀ ਕੰਫਰਟੇਬਲ ਸਨ ਮੈਨੂੰ ਇੰਨੇ ਕੰਫਰਟੇਬਲ ਅੱਜ ਤੱਕ ਕੋਈ ਵੀ ਹੈੱਡਫੋਨ ਨਹੀ ਸਨ ਮਿਲੇ ਅਤੇ ਮੈਂ ਅੱਜ ਐਪ੍ਰੀਸ਼ੀਏਟ ਕਰਦੀ ਹਾਂ ਇਹਨਾਂ ਦੇ ਡਿਲੀਵਰੀ ਨੂੰ ਨੂੰ ਅਤੇ ਇਸ ਕੰਪਨੀ ਨੂੰ ਅਤੇ ਔਨਲਾਈਨ ਸ਼ੋਪਿੰਗ ਨੂੰ ਘਰ ਬੈਠੇ ਹੀ ਮੈਂ ਇਸ ਪ੍ਰੋਡਕਟ ਨੂੰ ਖਰੀਦ ਲਿਆ ਅਤੇ ਮੇਰਾ ਐਕਸਪੀਰੀਅੰਸ ਜੋ ਸੀ ਬਹੁਤ ਹੀ ਵਧੀਆ ਰਿਹਾ ਅਤੇ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ